ਵੈਸੇ ਤਾਂ ਪੰਜਾਬ ਦੀ ਧਰਤੀ ਸ਼ੁਰੂ ਤੋਂ ਹੀ ਪੰਜ ਪਾਣੀਆਂ ਦੀ ਧਰਤੀ ਰਹੀ ਹੈ ਕਾਫੀ ਸਾਰੇ ਲੋਕ ਪੰਜਾਬ ਨੂੰ ਪੰਜ ਪਾਣੀਆਂ ਦੀ ਧਰਤੀ ਕਰਕੇ ਹੀ ਜਾਣਦੇ ਨੇ ਪਰ ਸਾਡੇ ਖੇਤਰ ਦੇ ਵਿੱਚ ਯਾਨੀ ਸਾਡੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਦੋ ਹੀ ਨਦੀਆਂ ਆਉਂਦੇ ਨੇ ਪਹਿਲੀ ਤਾਂ ਰਾਵੀ ਦੂਸਰੀ ਬਿਆਸ ਦੋਨੇ ਹੀ ਨਦੀਆਂ ਹਿਮਾਚਲ ਪ੍ਰਦੇਸ਼ ਤੋਂ ਉਹ ਕੇ ਆਉਂਦੀਆਂ ਨੇ ਇੱਧਰ ਨੂੰ ਗੱਲ ਕੀਤੀ ਜਾਵੇ ਸਾਡੇ ਇੱਥੇ ਕੋਈ ਡੈਮ ਨਹੀਂ ਹੈ ਖਾਸਕਰ ਗੱਲ ਕੀਤੀ ਜਾਵੇ ਤਾਂ ਪਾਣੀ ਦੀ ਅਸੀਂ ਵਰਤੋਂ ਸਹੀ ਤਰੀਕੇ ਨਾਲ ਹੀ ਕਰਦੇ ਹਾਂ ਇੱਦਾਂ ਦੀ ਗੱਲ ਨਹੀਂ ਹੈ ਕਿ ਅਸੀਂ ਹਰ ਵੇਲੇ ਪਾਣੀ ਨੂੰ ਵੇਸਟ ਹੀ ਕਰਦੇ ਹਾਂ ਜਾਂ ਉਹਦੀ ਬਰਬਾਦੀ ਕਰਦੇ ਹਾਂ ਗੱਲ ਕੀਤੀ ਜਾਵੇ ਪਾਣੀ ਦੀ ਵਰਤੋਂ ਅਸੀਂ ਸਹੀ ਤਰੀਕੇ ਨਾਲ ਇਸ ਤਰੀਕੇ ਨਾਲ ਕਰ ਸਕਦੇ ਹਾਂ ਕਿ ਜੋ ਸਾਡੇ ਕੋਲ ਬਚਿਆ ਹੋਇਆ ਪਾਣੀ ਹੈ ਅਸੀਂ ਉਸ ਨੂੰ ਸਹੀ ਤਰੀਕੇ ਤੇ ਯੂਜ ਕਰ ਸਕਦੇ ਜਿੱਦਾਂ ਪੌਦਿਆਂ ਨੂੰ ਪਾਣੀ ਦੇ ਦਿੱਤਾ ਜਾਂ ਬੂਟਿਆਂ ਨੂੰ ਪਾਣੀ ਦੇ ਦਿੱਤਾ ਇਹਦੇ ਨਾਲ ਇਹ ਹੋਏਗਾ ਕਿ ਜੋ ਪਾਣੀ ਬਚਿਆ ਵੀ ਹੋਵੇਗਾ ਉਹ ਧਰਤੀ ਦੇ ਥੱਲੇ ਚਲਾ ਜਾਵੇਗਾ ਪਾਣੀ ਦੀ ਵਰਤੋਂ ਸਹੀ ਤਰੀਕੇ ਨਾਲ ਕਰਨ ਨਾਲ ਸਾਨੂੰ ਬਹੁਤ ਸਾਰੇ ਫਾਇਦੇ ਹੋਣਗੇ ਪਹਿਲਾਂ ਤਾਂ ਇਹ ਕਿ ਪਾਣੀ ਗਲਤ ਤਰੀਕੇ ਨਾਲ ਬਰਬਾਦ ਨਹੀਂ ਹੋਏਗਾ ਦੂਸਰੀ ਗੱਲ ਇਹ ਪਾਣੀ ਉਹੀ ਜਗ੍ਹਾ ਲੱਗੇਗਾ ਜਿੱਥੇ ਜ਼ਰੂਰਤ ਹੈ ਅਸੀਂ ਗੱਲ ਕੀਤੀ ਜਾਵੇ ਸਾਡੇ ਇੱਥੇ ਰਾਵੀ ਅਤੇ ਬਿਆਸ ਨਦੀ ਦੀ ਦੋਨੇ ਨਦੀਆਂ ਹਿਮਾਚਲ ਤੋਂ ਆਉਂਦੀਆਂ ਨੇ ਅਤੇ ਜੇ ਗੱਲ ਕੀਤੀ ਜਾਵੇ ਡੈਮ ਦੀ ਸਾਡੇ ਇੱਥੇ ਡੈਮ ਤਾਂ ਹੈ ਨਹੀਂ ਕੋਈ ਪਰ ਸਾਡੇ ਲਾਗੇ ਇੱਕ ਸਟੇਟ ਗੱਲ ਕੀਤੀ ਜਾਵੇ ਹਿਮਾਚਲ ਦੇ ਲਾਗੇ ਹੀ ਪਠਾਨਕੋਟ ਸ਼ਹਿਰ ਦੇ ਲਾਗੇ ਜੋ ਕਿ ਪੰਜਾਬ ਦੇ ਵਿੱਚ ਹੀ ਹੈ ਉੱਥੇ ਇੱਕ ਡੈਮ ਹੈ ਅਤੇ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਡੈਮ ਦੇ ਹੁੰਦਿਆਂ ਹੀ ਸਾਡੇ ਇੱਥੇ ਪਾਣੀ ਆ ਰਿਹਾ ਹੈ ਡਾ ਡੈਮ ਤੋਂ ਹੀ ਹੁੰਦਿਆਂ ਵੈਸੇ ਪਾਣੀ ਆਉਂਦਾ ਗੁਰਦਾਸਪੁਰ ਸ਼ਹਿਰ ਦੇ ਵਿੱਚ ਪਰ ਗੱਲ ਕੀਤੀ ਜਾਵੇ ਰਾਵੀ ਅਤੇ ਬਿਆਸ ਉਹ ਡਾਇਰੈਕਟ ਹਿਮਾਚਲ ਪ੍ਰਦੇਸ਼ ਤੋਂ ਹੀ ਹੋ ਕੇ ਆਉਂਦੀਆਂ ਨੇ ਥੈਂਕ ਯੂ